ਸੋਲ੍ਹਾਂ ਜੂਨ ਉੱਨੀ ਸੌ ਸਤਾਸੀ ਨੂੰ ਮੇਰਾ ਜਨਮਦਿਨ ਸਤਾਰ੍ਹਾਂ ਅਕਤੂਬਰ ਉੱਨੀ ਸੌ ਅਠਾਸੀ ਨੂੰ ਮੇਰੇ ਹਸਬੈਂਡ ਦਾ ਜਨਮਦਿਨ ਚਾਰ ਦਸੰਬਰ ਦੋ ਹਜ਼ਾਰ ਚੌਦ੍ਹਾਂ ਨੂੰ ਮੇਰੀ ਵੱਡੀ ਬੇਟੀ ਦਾ ਜਨਮਦਿਨ ਦੋ ਮਈ ਦੋ ਹਜ਼ਾਰ ਬਾਈ ਨੂੰ ਮੇਰੀ ਛੋਟੀ ਬੇਟੀ ਦਾ ਜਨਮਦਿਨ ਛੇ ਅਕਤੂਬਰ ਦੋ ਹਜ਼ਾਰ ਤੇਰ੍ਹਾਂ ਨੂੰ ਸਾਡੀ ਵਿਆਹ ਦੀ ਵਰ੍ਹੇਗੰਢ